ਹੈਲੋ ਹਾਂ ਅੱਜ ਐਕਚੁਲੀ ਨਾ ਕੀ ਹੈ ਮੈਂ ਥੋੜ੍ਹਾ ਬੱਚਿਆਂ ਦੇ ਬਾਰੇ ਡਿਸਕਸ ਕਰਨ ਵਾਸਤੇ ਜੇ ਯਾਦ ਕੀਤਾ ਤੁਹਾਨੂੰ ਔਰ ਹਾਂ ਬੱਚੇ ਠੀਕ ਆ ਹੋਰ ਤੁਹਾਡਾ ਕੀ ਹਾਲ ਹੈ ਹੋਰ ਪੜ੍ਹਾਈ ਠੀਕ ਚੱਲ ਰਹੀ ਹੈ ਬਸ ਇਸ ਤਰ੍ਹਾਂ ਹੀ ਹੈ ਯਾਰ ਪਤਾ ਹਾਂ ਬਿਲਕੁਲ ਠੀਕ ਹੈ ਅਤੇ ਮੈਂ ਭੈਣ ਜੀ ਵੀ ਇਹ ਪਹਿਲਾਂ ਤਾਂ ਦੇਖੋ ਬੱਚੇ ਪੜ੍ਹਦੇ ਪਏ ਸੀ ਪੰਜਾਬ ਐ ਬੋਰਡ ਸਕੂਲ ਐਜੂਕੇਸ਼ਨ ਵਿੱਚ ਠੀਕ ਹੈ ਨਾ ਅਤੇ ਹੁਣ ਬੱਚਿਆਂ ਦਾ ਅੱਜ ਕੱਲ੍ਹ ਜੋ ਮਾਹੌਲ ਚੱਲ ਰਿਹਾ ਤੁਸੀਂ ਦੇਖਦੇ ਹੀ ਹੋ ਕਿਵੇਂ ਦਾ ਮਾਹੌਲ ਹੈ ਇੰਗਲਿਸ਼ 'ਤੇ ਜ਼ੋਰ ਇੰਗਲਿਸ਼ 'ਤੇ ਜ਼ੋਰ ਮਤਲਬ ਉਹੀ ਹੈ ਕਿ ਬੱਚਿਆਂ ਨੇ ਅੱਗੋਂ ਜਿਵੇਂ ਜਾਣਾ ਹੋਵੇ ਕਿਸੇ ਐਗਜ਼ਾਮ ਵਿੱਚ ਠੀਕ ਹੈ ਨਾ ਕੰਪੀਟੀ ਕੰਪਟੀਸ਼ਨ ਐਗਜਾਮ ਵਿੱਚ ਅਤੇ ਉਹ ਉਹਦੇ ਵਾਸਤੇ ਇੰਗਲਿਸ਼ ਮਸਟ ਹੈ ਭਾਵੇਂ ਮੈਂ ਸੋਚਦੀ ਹਾਂ ਕਿ ਪੰਜਾਬਬੋਰਡ ਐਜੂਕੇਸ਼ਨ ਸਕੂਲ ਵਿੱਚ ਪੜ੍ਹਾਉਂਦੇ ਨੇ ਪੰਜਾਬੀ ਤਾਂ ਉਹ ਇੰਗਲਿਸ਼ ਪੜ੍ਹਾਉਂਦੇ ਨੇ ਬਟ ਪੰਜਾਬੀ ਵੀ ਨਾਲ ਉਹ ਪੰਜਾਬੀ ਤਾਂ ਚਲੋ ਠੀਕ ਹੈ ਪਰ ਨੋ ਨੋਰਮਲੀ ਸਬਜੈਕਟ ਹੁੰਦਾ ਨਾ ਬੱਚਿਆਂ ਨੂੰ ਜਿਹੜਾ ਆਪਾਂ ਸਕੂਲ ਵਿੱਚ ਕਿਸ ਤਰ੍ਹਾਂ ਪੜ੍ਹਾਇਆ ਜਾਂਦਾ ਹੈ ਕੀ ਹੈ ਕਿਵੇਂ ਹੈ ਪਰ ਜਿਵੇਂ ਅੱਜ ਕੱਲ੍ਹ ਦਾ ਕੰਪਟੀਸ਼ਨ ਦਾ ਜ਼ਮਾਨਾ ਹੈ ਕਿ ਬੱਚੇ ਨੂੰ ਇਸ ਤਰ੍ਹਾਂ ਹਰ ਚੀਜ਼ ਬਾਰੇ ਨੋਲੇਜ ਹੋਵੇ ਜਨਰਲ ਨੌਲੇਜ ਹੋਵੇ ਤਾਂ ਕਿ ਉਹ ਜਿਹੜਾ ਕੰਪਟੀਸ਼ਨ 'ਚ ਬੈਠੇ ਅਤੇ ਮਤਲਬ ਤਿਆਰੀ ਉਸ ਹੀ ਹਿਸਾਬ ਨਾਲ ਕਰ ਸਕੇ ਇਸ ਲਈ ਮਤਲਬ ਹਾਂ ਮੈਂ ਸੋਚ ਰਹੀ ਹਾਂ ਕਿ ਬੱਚਿਆਂ ਨੂੰ ਨਾ ਸੀ ਬੀ ਐਸ ਈ ਸਕੂਲ ਵਿੱਚ ਕਰਵਾਈਏ ਕਿ ਬੱਚੇ ਹਾਂ ਨਹੀਂ ਮੈਂ ਮੈਂ ਉਹ ਗੱਲ ਤੁਹਾਡੇ ਨਾਲ ਐਗਰੀ ਕਰਦੀ ਹੈ ਕਿ ਪੜ੍ਹਾਈ ਜਾਂਦੇ ਨੇ ਸਰਕਾਰੀ ਸਕੂਲਾਂ 'ਚ ਬਟ ਹਾਂ ਉਹ ਤਾਂ ਠੀਕ ਹੈ ਪਰ ਜੋ ਅੱਜ ਕੱਲ੍ਹ ਦਾ ਸਟੈਂਡਰਡ ਹੋ ਗਿਆ ਜਿਸ ਤਰ੍ਹਾਂ ਬੱਚੇ ਅੱਜ ਕੱਲ੍ਹ ਦੇ ਸਟੈਂਡਰਡ 'ਚ ਚਾਹੁੰਦੇ ਨੇ ਠੀਕ ਹੈ ਸਟੈਂਡਰਡ ਹੋਵੇ ਕਿ ਮਤਲਬ ਬੱਚੇ ਕਿਸ ਤਰ੍ਹਾਂ ਹਾਂ ਸ਼ਹਿਰੀ ਬੱਚਿਆਂ ਦੇ ਮੁਕਾਬਲੇ ਹਾਂ ਹਾਂ ਨੈਚੁਰਲ ਐਲਕੀ ਉਹਦੇ ਅਕੋਰਡਿੰਗਲੀ ਮੈਮ ਸੋਚਦੀ ਹਾਂ ਕਿ ਸੀ ਬੀ ਐਸ ਈ ਸਕੂਲ 'ਚ ਐਡਮਿਸ਼ਨ ਕਰਵਾ ਦਈਏ ਕਿ ਜਿਹਦੇ ਨਾਲ ਕਿ ਯਾਰ ਆਪਣੇ ਭੈਣ ਜੀ ਆਪਣੇ ਨਸੀਤਾਂ ਇਹ ਹੈਗਾ ਇੱਕ ਸੇਨ ਜੋਸਫ ਹੈ ਇੱਕ ਸੇ ਹਾਂ ਸੇਨ ਜੋ ਜੋਸਫ ਆਈ ਸੀ ਐਸ ਸੀ ਨਾਲ ਹੈ ਅਤੇ ਬਟ ਮੈਂ ਹਾਂ ਹਾਂ ਮੈਂ ਸੀ ਬੀ ਐਸ ਈ ਸਕੂਲ ਏ ਪੀ ਜੇ ਹੈਗਾ ਠੀਕ ਹੈ ਦੈਨ ਏ ਪੀ ਜੇ ਹੈਗਾ ਦੈਨ ਆਈ ਵੀ ਏ ਆਈ ਵੀ ਵਾਈ ਹੈਗਾ ਅਤੇ ਹੋਰ ਵੀ ਇੱਕ ਦੋ ਸਕੂਲ ਹੈਗੇ ਆਲੇ ਦੁਆਲੇ ਡਿਪਸ ਹੈਗਾ ਹੋਰ ਇਕ ਦੋ ਹੈਗੇ ਮੈਂ ਕਿਹਾ ਸਾਰੇ ਜਾ ਕੇ ਦੇਖ ਕੇ ਫਿਰ ਕੰਪੈਰੀਜਨ ਕਰਕੇ ਦੇਖਦੇ ਹੈ ਕਿ ਕਿਹੜਾ ਸਕੂਲ ਅੱਛਾ ਹਾਂ ਹਾਂ ਫੀਸਾਂ ਦਾ ਵੀ ਇਹ ਬਟ ਹੈ ਤਾਂ ਹੈਗਾ ਪੜ੍ਹਾਈ 'ਚ ਸਰਕਾਰੀ ਸਕੂਲਾਂ 'ਚ ਕੋਸ਼ਿਸ਼ ਤਾਂ ਕਰ ਰਹੇ ਨੇ ਬਟ ਜੋ ਸਟੈਂਡਰਡ ਸੀ ਬੀ ਐਸ ਈ ਸਕੂਲਾਂ ਦਾ ਉਹ ਨੈਚੁਰਲ ਉਹਦਾ ਹੀ ਹੈ ਠੀਕ ਹੈ ਨਾ ਹੁਣ ਜਿਵੇਂ ਸਰਕਾਰੀ ਜਿਵੇਂ ਹੁਣ ਸਰਕਾਰੀ ਸਕੂਲ ਵਿੱਚ ਅੱਠਵੀਂ ਉਹ ਕਰਵਾਉਂਦੇ ਬੋਰਡ ਦੀ ਹੁਣ ਸੀ ਬੀ ਐਸ ਈ ਸਕੂਲ 'ਚ ਇਸ ਤਰ੍ਹਾਂ ਦੀ ਕੋਈ ਜਾ ਕੇ ਟੈਂਨਥ ਹੀ ਹੋਣੀ ਹੈ ਬੋਡ ਦੀ ਔਰ ਪਲਸ ਟੂ ਹੋਣੀ ਹੈ ਠੀਕ ਹੈ ਨਾ ਹੁਣ ਸਰਕਾਰੀ ਸਕੂਲਾਂ 'ਚ ਪੰਜਵੀਂ ਹੋ ਜਾਂਦੀ ਅੱਠਵੀਂ ਹੋ ਜਾਂਦੀ ਉਨਾ ਬੱਚਾ ਮੈਂਟਲੀ ਵੀ ਸਟਰੈਸ ਰਹਿੰਦਾ ਹਾਂ ਸੀ ਬੀ ਐਸ ਸੀ ਦਾ ਸਿਲੇਬਸ ਥੋੜ੍ਹਾ ਘੱਟ ਹੈ ਔਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਬਹੁਤ ਜ਼ਿਆਦਾ ਹਾਂ ਬਹੁਤ ਜ਼ਿਆਦਾ ਅਤੇ ਸੋਚ ਰਹੀ ਹਾਂ ਹਾਂ ਬਾਕੀ ਦੇਖਦੇ ਹਾਂ ਤੁਸੀਂ ਵੀ ਆਪਣੇ ਵਿਚਾਰ ਦੱਸਣਾ ਕਿ ਕਿਹੜਾ ਸਕੂਲ ਠੀਕ ਹੈਗਾ ਉਹਦੇ ਵਿੱਚ ਹੀ ਟਰਾਈ ਕਰ ਲੈਂਦੇ ਹਾਂ ਠੀਕ ਹੈ ਨਾ ਹਾਂ ਆਪਾਂ ਠੀਕ ਹੈ ਠੀਕ ਹੈ ਹਾਂ ਹਾਂ ਹਾਂ ਅੱਛਾ ਜੀ ਹਾਂ ਹਾਂ ਹਾਂ ਸਹੀ ਗੱਲ ਹੈ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂ ਠੀਕ ਹੈ ਥੈਂਕ ਯੂ ਸੋ ਮਚ ਓਕੇ ਬਾਏ ਸਤਿ ਸ਼੍ਰੀ ਅਕਾਲ